ਮੈਂ ਰਜੇਸ਼ ਕੁਮਾਰ ਵਾਸੀ ਫ਼ਿਰੋਜ਼ਪੁਰ ਕਲਾਂ ਦਾ ਰਹਿਣ ਵਾਲਾ ਹਾਂ ਅੱਜ ਮੈਂ ਤੁਹਾਨੂੰ ਦੱਸਦਾ ਹਾਂ ਕਿ ਸਿਹਤਮੰਦ ਪਕਵਾਨ ਕਿਹੜੇ ਹਨ ਉਂਝ ਤਾਂ ਕਦੀ ਵੀ ਸਾਨੂੰ ਕੋਈ ਸਿਹਤਮੰਦ ਪਕਵਾਨ ਦੀ ਗੱਲ ਕਰਦਿਆਂ ਕਰਦਿਆਂ ਮੈਨੂੰ ਯਾਦ ਆਇਆ ਕਿ ਜਦੋਂ ਵੀ ਮੈਨੂੰ ਮੋਕਾ ਮਿਲਦਾ ਹੈ ਤਾਂ ਮੈਂ ਬੱਚਿਆਂ ਅਤੇ ਆਪਣੇ ਮਨਪਸੰਦ ਨਮਕੀਨ ਚਾਵਲ ਹੀ ਬਣਾਉਂਦਾ ਹਾਂ ਜੋ ਕਿ ਮੈਨੂੰ ਬੜੇ ਵਧੀਆ ਤਰੀਕੇ ਨਾਲ ਬਣਾਉਣੇ ਆਉਂਦੇ ਹਨ ਅਤੇ ਸਭ ਨੂੰ ਪਸੰਦ ਵੀ ਆਉਂਦੇ ਹਨ ਪਰ ਜੇਕਰ ਮੈਂ ਸਿਹਤਮੰਦ ਪਕਵਾਨਾਂ ਦੀ ਗੱਲ ਕਰਾਂ ਤਾਂ ਉਹ ਪੂਰੀ ਚਨੇ ਕੜਾਹ ਪ੍ਰਸ਼ਾਦ ਪਕੌੜੇ ਆਦਿ ਹਨ ਜੋ ਕਿ ਸਾਡੇ ਘਰ ਕਦੀ ਕਦਾਈ ਬਣਦੇ ਹਨ ਅਤੇ ਅਸੀਂ ਉਸ ਉਨ੍ਹਾਂ ਚੀਜ਼ਾਂ ਨੂੰ ਚਾਹ ਨਾਲ ਜਾਂ ਬੜੇ ਹੀ ਵਧੀਆ ਤਰੀਕੇ ਦੇ ਨਾਲ ਪ੍ਰਾਪਤ ਕਰਕੇ ਖਾਂਦੇ ਹਾਂ ਧੰਨਵਾਦ